ਮੈਂ ਤੁਹਾਨੂੰ ਅਸਲ ਦੇ ਵਿੱਚ ਜਿਹੜਾ ਆਪਣਾ ਪੋਜੀਟਿਵ ਐਕਸਪੀਰੀਅੰਸ ਦੱਸਣਾ ਚਾਹੁੰਦੀ ਹਾਂ ਜਿਹੜਾ ਮੇਰਾ ਹੋਇਆ ਜਿਹੜਾ ਮੈਂ ਤੁਹਾਨੂੰ ਆਪਣਾ ਕੁੱਕਵੇਅਰ ਜਿਹੜੀ ਆਪਣੀ ਖਰੀਦੀ ਕਰੋਕਰੀ ਕਿਚਨ ਦੇ ਵਿੱਚ ਉਹਦੇ ਰਿਗਾਰਡਿੰਗ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਵੀ ਮੈਨੂੰ ਬਹੁਤ ਵਧੀਆ ਕਰੋਕਰੀ ਮਿਲੀ ਬਾਈ ਚਾਂਸ ਮੇਰਾ ਪ੍ਰੋਡਕਟ ਬਹੁਤ ਵਧੀਆ ਸੀਗਾ ਅਤੇ ਮੈਂ ਔਨਲਾਈਨ ਔਡਰ ਕੀਤਾ ਜੀ ਅਤੇ ਇਹਦੇ 'ਚ ਮੈਨੂੰ ਲੋੜ ਸੀਗੀ ਆਪਣਾ ਜਿਹੜੀਆਂ ਹਾਂਡੀ ਦੀ ਅਤੇ ਦੋ ਫਰਾਇੰਗ ਪੈਨ ਦੀ ਅਤੇ ਉਹ ਗ੍ਰੇਨਾਈਟ ਦੇ ਸੀਗੇ ਗ੍ਰੇਨਾਈਟ ਜਿਹੜਾ ਹੈਗਾ ਮਟੀਰੀਅਲ ਉਹਦੇ ਅਤੇ ਮੈਨੂੰ ਸੀ ਬਹੁਤ ਬੜਾ ਸਾਈਜ਼ ਵੀ ਨਹੀਂ ਚਾਹੀਦਾ ਕਿਉਂਕਿ ਉਹ ਪਹਿਲਾਂ ਮੇਰੇ ਕੋਲ ਬਹੁਤ ਵੱਡੇ ਭਾਂਡੇ ਸੀਗੇ ਅਤੇ ਮੈਨੂੰ ਮੈਂ ਨੋਨ ਸਟਿੱਕ ਵੀ ਨਹੀਂ ਸੀ ਲੈਣਾ ਚਾਹੁੰਦੀ ਅਤੇ ਉਹਦੇ 'ਚ ਵੀ ਮੈਂ ਸੁਣਿਆ ਸੀ ਵੀ ਕਾਫ਼ੀ ਹਾਰਮਫੁੱਲ ਕੈਮੀਕਲਸ ਹੁੰਦੇ ਨੇ ਜਿਹੜੇ ਆਪਣੇ ਖਾਣੇ ਦੇ ਵਿੱਚ ਮਿਲ ਜਾਂਦੇ ਨੇ ਅਤੇ ਗ੍ਰੇਨਾਈਟ ਵਾਲਿਆਂ ਦਾ ਮੈਨੂੰ ਸਾਰਿਆਂ ਨੇ ਬੜਾ ਵਧੀਆ ਐਕਸਪੀਰੀਅੰਸ ਕਿਹਾ ਸੀ ਵੀ ਨਹੀਂ ਇਹਦੇ 'ਚ ਕੋਈ ਇੱਦਾਂ ਦਾ ਜਿਹੜਾ ਹੈਗਾ ਹਾਨੀਕਾਰਕ ਤੱਤ ਨਹੀਂ ਹੈਗਾ ਅਤੇ ਇਹਨਾਂ ਦਾ ਮਟੀਰੀਅਲ ਬਹੁਤ ਵਧੀਆ ਅਤੇ ਇਸ ਕਰਕੇ ਜੀ ਮੈਂ ਇਹ ਔਡਰ ਕੀਤਾ ਪ੍ਰੋਡਕਟ ਅਤੇ ਮੈਨੂੰ ਜਿਹੜਾ ਹੈਗਾ ਇਹਦੇ ਥਰੂ ਫਲਿੱਪਕਾਰਟ ਦੇ ਥਰੂ ਮੈਨੂੰ ਉਹ ਔਡਰ ਮਿਲਿਆ ਦੀਵਾਲੀ ਦੇ ਨੇੜੇ ਮੈਨੂੰ ਕਾਫ਼ੀ ਡਿਸਕਾਊਂਟ ਵੀ ਮਿਲ ਗਿਆ ਉਹਦੇ 'ਤੇ ਆਲਮੋਸਟ ਅੱਸੀ ਪਰਸੈਂਟ ਡਿਸਕਾਊਂਟ 'ਤੇ ਸੀ ਅਤੇ ਜਦੋਂ ਮੈਨੂੰ ਰਿਸੀਵ ਹੋਇਆ ਤਾਂ ਬਹੁਤ ਵਧੀਆ ਪਹਿਲਾਂ ਤਾਂ ਫਲਿੱਪਕਾਰਟ ਵਾਲਿਆਂ ਦਾ ਐਕਸਪੀਰੀਅੰਸ ਬਹੁਤ ਵਧੀਆ ਸੀਗਾ ਉਹਨਾਂ ਨੇ ਵਿਦਇਨ ਮੈਨੂੰ ਪੰਜ ਦਿਨ ਕਹੇ ਹੋਏ ਸੀ ਤਿੰਨ ਦਿਨ ਦੇ ਵਿੱਚ ਵਿੱਚ ਮੇਰਾ ਔਡਰ ਆ ਗਿਆ ਅਤੇ ਉਹ ਤੋਂ ਬਾਅਦ ਜੀ ਜਦੋਂ ਮੈਂ ਭਾਂਡੇ ਵਰਤੇ ਤਾਂ ਉਹ ਬਹੁਤ ਹੀ ਵਧੀਆ ਮੇਰਾ ਰਿਹਾ ਐਕਸਪੀਰੀਅੰਸ ਈਵਨ ਜਿਹੜੇ ਆਪਾਂ ਸਟੀਲ ਵਾਲੇ ਜਾਂ ਹੋਰ ਦੂਜੇ ਭਾਂਡੇ ਵਰਤਦੇ ਹਾਂ ਉਹਨਾਂ ਨਾਲ਼ੋਂ ਸਭ ਤੋਂ ਪਹਿਲਾਂ ਤਾਂ ਜਿਹੜੇ ਮੈਂ ਇਹ ਮੰਗਵਾਈ ਸੀ ਫਰਾਇੰਗ ਪੈਨ ਔਰ ਕੜਾਹੀ ਮੇਰੀ ਬਹੁਤ ਹੀ ਵਧੀਆ ਨਿਕਲੀ ਅਤੇ ਪਹਿਲਾਂ ਤਾਂ ਇਹਨਾਂ ਨੂੰ ਸਾਫ਼ ਕਰਨਾ ਬਹੁਤ ਵਧੀਆ ਦੂਜ ਮਤਲਬ ਕਿਹਾ ਜਾਵੇ ਵੀ ਨਾ ਤਾਂ ਕੋਈ ਖਾਣਾ ਚਿਪਕਦਾ ਇਹਦੇ ਨਾਲ਼ ਦੂਜਾ ਜੀ ਬ ਜਿਵੇਂ ਅੱਜ ਕੱਲ੍ਹ ਆਪਾਂ ਨੂੰ ਸਾਰਿਆਂ ਨੂੰ ਬਹੁਤ ਬਿਮਾਰੀਆਂ ਨੇ ਸਿਹਤ ਦੇ ਬੜੇ ਸਾਰੇ ਇਸ਼ੂਜ਼ ਨੇ ਵੀ ਘੱਟ ਤੇਲ ਚਾਹੀਦਾ ਘੱਟ ਸਾਨੂੰ ਜੀ ਜਿਹੜਾ ਹੈਗਾ ਬਹੁਤ ਫਰਾਈਡ ਚੀਜ਼ਾਂ ਨਹੀਂ ਅਸੀਂ ਖਾਣਾ ਪਸੰਦ ਕਰਦੇ ਇਹਦੇ 'ਚ ਜਮਾਂ ਹੀ ਮਾੜੇ ਮੋਟੇ ਜਿਹੇ ਤੇਲ ਨਾਲ਼ ਬਸ ਜੇ ਆਪਾਂ ਹਲਕਾ ਜਿਹਾ ਟੱਚ ਕਰ ਦਈਏ ਵੀ ਹਾਂ ਉਹਨੂੰ ਅਤੇ ਉਹਦੇ ਨਾਲ਼ ਵੀ ਸਾਡਾ ਜਿਹੜਾ ਕੰਮ ਚੱਲ ਜਾਂਦਾ ਅਤੇ ਬਹੁਤ ਖਾਣਾ ਜਿਹੜਾ ਜਿਵੇਂ ਆਪਾਂ ਪ੍ਰੋਪਰ ਐਨ ਪੂਰਾ ਫਰਾਈਡ ਵਾਂਗੂੰ ਤੁਹਾਡਾ ਬਣਦਾ ਅਤੇ ਚਿਪਕਦਾ ਨਹੀਂ ਹੈਗਾ ਥੱਲੇ ਉੱਪਰੋਂ ਦੀ ਇਹਨੂੰ ਸਾਫ਼ ਕਰਨਾ ਬਹੁਤ ਵਧੀਆ ਜਮਾਂ ਮਤਲਬ ਕੋਈ ਤੁਹਾਨੂੰ ਰਗੜਨ ਦੀ ਲੋੜ ਨਹੀਂ ਪੈਂਦੀ ਬਸ ਇੰਨਾ ਕੁ ਧਿਆਨ ਦੇਣਾ ਹੁੰਦਾ ਵੀ ਤੁਸੀਂ ਬਹੁਤ ਜਿਹੜਾ ਮ ਜ਼ਿਆਦਾ ਤਿੱਖਾ ਕੂਚੀ ਨਹੀਂ ਵਰਤਣੀ ਹੈਗੀ ਅਤੇ ਆਮ ਨੋਰਮਲ ਆਪਣੀ ਸਪੰਜ ਦੇ ਨਾਲ਼ ਏ ਜਦ ਆਪਾਂ ਸਾਫ਼ ਕਰਦੇ ਹਾਂ ਨੋਰਮਲ ਪਾਣੀ ਦੇ ਨਾਲ਼ ਵੀ ਆਪਾਂ ਕਹੀਏ ਗਰਮ ਪਾਣੀ ਦੀ ਵੀ ਨਹੀਂ ਲੋੜ ਪੈਂਦੀ ਬੜਾ ਸੋਹਣਾ ਸਾਫ਼ ਹੋ ਜਾਂਦੇ ਨੇ ਅਤੇ ਕੋਈ ਤੁਹਾਨੂੰ ਬਹੁਤਾ ਰਗੜਨਾ ਨਹੀਂ ਪੈਂਦਾ ਕੋਈ ਇਹਦੇ ਉੱਤੇ ਦਾਗ਼ ਧੱਬੇ ਨਹੀਂ ਪੈਂਦੇ ਹੈਗੇ ਹਲਦੀ ਦਾ ਦਾਗ਼ ਜਾਂ ਕੁਛ ਹੋਰ ਅਤੇ ਮ ਕੜਛੀ ਵੀ ਆਪਾਂ ਜਿਹੜੀ ਮਰਜ਼ੀ ਲਾ ਸਕਦੇ ਨਹੀਂ ਤਾਂ ਦੂਜੇ ਭਾਂਡਿਆਂ ਦੇ ਵਿੱਚ ਇਹ ਹੋ ਜਾਂਦਾ ਜੀ ਵੀ ਕਿਹੜੀ ਕੜਛੀ ਲਾਉਣੀ ਆ ਆਪਾਂ ਜਿਹੜੀ ਤਿੱਖੀ ਕੜਛੀ ਨਹੀਂ ਯੂਜ ਕਰਦੇ ਜਿਹੜੀ ਮਰਜ਼ੀ ਕੜਛੀ ਯੂਜ ਕਰੋ ਅਤੇ ਖਾਣਾ ਬੜਾ ਵਧੀਆ ਬਣਿਆ ਬੜਾ ਸਵਾਦ ਵੀ ਬਣਿਆ ਅਤੇ ਘੱਟ ਤੇਲ ਦੇ ਵਿੱਚ ਆਪਾਂ ਨੂੰ ਜਿਵੇਂ ਕਹਿੰਦੇ ਹਾਂ ਆਪਣੀ ਸਿਹਤ ਦਾ ਵੀ ਖ਼ਿਆਲ ਰੱਖ ਕੇ ਹਰ ਚੀਜ਼ ਮੈਨੂੰ ਬੜਾ ਵਧੀਆ ਲੱਗਿਆ ਇਹ ਸੋ ਇਸ ਕਰਕੇ ਜਿਹੜੀ ਮੈਂ ਰਿਕਮੈਂਡ ਕਰੂੰਗੀ ਵੀ ਜਿਹੜੀ ਆਪਣੀ ਪ੍ਰੈਸਟੀਜ਼ ਦੀ ਆਹ ਆਪਣਾ ਰੇਂਜ ਹੈਗੀ ਆ ਗ੍ਰੇਨਾਈਟ ਵਾਲੀ ਅਤੇ ਇਹ ਹੈਲਥ ਪੱਖੋਂ ਵੀ ਸਿਹਤ ਪੱਖੋਂ ਵੀ ਬਹੁਤ ਵਧੀਆ ਹੈਗੀ ਅਤੇ ਵੀ ਅਦਰਵਾਈਜ਼ ਦੇਖਣ ਪੱਖੋਂ ਵੀ ਔਰ ਸਾਂਭ ਸੰਭਾਲ ਪੱਖੋਂ ਬੜਾ ਵਧੀਆ ਮੈਨੂੰ ਲੱਗੀ ਪ੍ਰੋਡਕਟ ਇਹ